ਸਤਿ ਸ਼੍ਰੀ ਅਕਾਲ ਸਰ ਕੀ ਮੈਂ ਤੁਹਾਡੇ ਮੈਨੇਜਰ ਨਾਲ ਗੱਲ ਕਰ ਰਹੀ ਹਾਂ ਜੇ ਮੈਨੇਜਰ ਨਾਲ ਨਹੀਂ ਗੱਲ ਕਰ ਰਹੀ ਤਾਂ ਕਿਰਪਾ ਕਰਕੇ ਤੁਸੀਂ ਮੈਨੂੰ ਮੇਰੇ ਆ ਤੁਸੀਂ ਮੈਨੂੰ ਆਪਣੇ ਰੈਸਟੋਰੈਂਟ ਦੇ ਮੈਨੇਜਰ ਨਾਲ ਗੱਲ ਕਰਵਾ ਸਕਦੇ ਹੋ ਹਾਂਜੀ ਸਰ ਹਾਂ ਠੀਕ ਹੈ ਹਾਂ ਸਤਿ ਸ਼੍ਰੀ ਅਕਾਲ ਸਰ ਹਾਂਜੀ ਸਰ ਤੁਸੀਂ ਮੈਨੂੰ ਕਿਰਪਿਆ ਕਰਕੇ ਆਪਣੇ ਰੈਸਟੋਰੈਂਟ ਦੀ ਖਾਣ ਪੀਣ ਦੀ ਜਾਣਕਾਰੀ ਦੇ ਸਕਦੇ ਹੋ ਕਿ ਹਾਂਜੀ ਕੀ ਤੁਹਾਡੇ ਉ ਉੱਥੇ ਖਾਣ ਪੀਣ ਕਿੱਦਾਂ ਦਾ ਖਾਣ ਪੀਣ ਹੈ ਬਣਦਾ ਹਾਂਜੀ ਕਿ ਨੋਨ ਵੈੱਜ ਹੈ ਵੈੱਜ ਹੈ ਮਿੱਠੇ 'ਚ ਕੀ ਹੈ ਕਿੱਦਾਂ ਦੀ ਤੁਸੀਂ ਸਰਵਿੰਗ ਕਰ ਸਕਦੇ ਹੋ ਹਾਂਜੀ ਹਾਂਜੀ ਸਰ ਹਾਂਜੀ ਠੀਕ ਹੈ ਸਰ ਅਤੇ ਤੁਸੀਂ ਮੈਨੂੰ ਇੱਕ ਇੱਕ ਹੋਰ ਗੱਲ ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਸੀ ਕਿ ਤੁਹਾਡੇ ਟੇਬਲ ਦੀ ਉਪਲਬਧਤਾ ਕਿੰਨੀ ਹੈ ਕਿ ਹਾਂਜੀ ਕਿ ਇੰਨੇ ਤੋਂ ਇੰਨੇ ਮੈਕਸੀਮਮ ਲੋਕ ਲੋਕ ਜਾਂ ਪਰਸਨ ਆ ਕੇ ਇੱਕ ਜਗ੍ਹਾ 'ਤੇ ਬੈਠ ਕੇ ਖਾਣਾ ਖਾ ਸਕਦੇ ਨੇ ਹਾਂਜੀ ਸਰ ਹਾਂਜੀ ਸਰ ਠੀਕ ਆ ਸਰ ਓਕੇ ਸਰ ਯਾਨੀ ਕਿ ਚਾਰ ਤੋਂ ਛੇ ਜਾਣੇ ਆ ਕੇ ਇਕੱਠੇ ਬਹਿ ਕੇ ਖਾਣਾ ਖਾ ਸਕਦੇ ਨੇ ਹਾਂਜੀ ਸਰ ਠੀਕ ਹੈ ਸਰ ਹਾਂਜੀ ਓਕੇ ਸਰ ਕਿਉਂਕਿ ਮੈਂ ਆਪਣੇ ਪਰਿਵਾਰ ਦੇ ਨਾਲ ਆਉਣਾ ਚਾਹੁੰਦੀ ਹਾਂ ਅਤੇ ਇਸ ਕਰਕੇ ਮੈਂ ਤੁਹਾਨੂੰ ਪੁੱਛ ਰਹੀ ਸੀ ਹਾਂਜੀ ਸਰ ਠੀਕ ਹੈ ਸਰ ਅਤੇ ਤੁਸੀਂ ਮੈਨੂੰ ਇਹ ਦੱਸ ਸਕਦੇ ਹੋ ਕਿ ਤੁਹਾਡੇ ਬੁਕਿੰਗਸ ਕਿੱਦਾਂ ਹੋਣਗੀਆਂ ਕਿ ਹਾਂ ਕਿ ਇਹ ਤੁਹਾਡਾ ਤੁਹਾਡੇ ਇੱਥੇ ਰੈਸਟੋਰੈਂਟ ਦੇ ਵਿੱਚ ਕਿੰਨੇ ਤੋਂ ਕਿੰਨੇ ਟਾਈਮਿੰਗ ਦੀ ਬੁਕਿੰਗ ਹੈ ਟੇਬਲ ਬੁੱਕ ਹੋ ਸਕਦੇ ਹੈ ਹਾਂਜੀ ਸਰ ਨੌ ਤੋਂ ਗਿਆਰਾਂ ਨੌ ਤੋਂ ਬਾਰਾਂ ਦੇ ਵਿੱਚ ਵਿੱਚ ਤੁਸੀਂ ਜਦੋਂ ਮਰਜ਼ੀ ਬੁਕਿੰਗ ਕਰਵਾ ਸਕਦੇ ਹੋ ਓਕੇ ਸਰ ਹਾਂਜੀ ਸਰ ਥੈਂਕ ਯੂ ਸਰ ਥੈਂਕ ਯੂ ਸਰ ਧੰਨਵਾਦ ਸਰ ਧੰਨਵਾਦ